ਪੰਜ ਜਨਵਰੀ ਦੋ ਹਜ਼ਾਰ ਸੋਲ੍ਹਾਂ ਅੱਠ ਜੁਲਾਈ ਦੋ ਹਜ਼ਾਰ ਵੀਹ ਅਠਾਰ੍ਹਾਂ ਜੂਨ ਦੋ ਹਜ਼ਾਰ ਪੰਦਰ੍ਹਾਂ ਗਿਆਰਾਂ ਨਵੰਬਰ ਦੋ ਹਜ਼ਾਰ ਇੱਕੀ ਚੌਵੀ ਅਕਤੂਬਰ ਉੱਨੀ ਸੌ ਅਠਾਸੀ